ਹਾਂਜੀ ਸਾਡੇ ਘਰ ਵਿੱਚ ਕੇ ਵਾਈ ਪੀ ਪ੍ਰੋਗਰਾਮ ਹੈ ਇਸ ਦਾ ਪੂਰਾ ਨਾਮ ਕੁਸ਼ਲ ਯੁਵਾ ਪ੍ਰੋਗਰਾਮ ਹੈ ਜੋ ਕਿ ਸਕਿਲ ਡਿਵਲਪਮੈਂਟ ਲਈ ਵਰਤਿਆ ਜਾਂਦਾ ਹੈ ਇਹ ਸਕਿਲ ਡਿਵਲਪਮੈਂਟ ਦੀ ਟ੍ਰੇਨਿੰਗ ਹੁੰਦੀ ਹੈ ਇਹ ਸਾਡੀ ਇਮਪਲੋਏਬਿਲਟੀ ਦੀ ਸਕਿਲ ਨੂੰ ਇਮਪਰੂਵ ਕਰਦੀ ਹੈ ਅਤੇ ਜ਼ਿਆਦਾਤਰ ਇਹ ਬਿਹਾਰ ਵਰਗੀਆਂ ਸਟੇਟਾਂ ਵਿੱਚ ਹੁੰਦੀ ਹੈ ਇਹ ਅਨਇਮਪਲੋਇਡ ਨੂੰ ਸਿੱਖਣ ਵਿੱਚ ਹੈਲਪ ਕਰਦੀ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਕਮਾਉਣ ਯੋਗ ਬਣਾ ਦਿੰਦੀ ਹੈ ਕਿਉਂਕਿ ਹਰ ਕਿਸੇ ਵਿੱਚ ਕੋਈ ਨਾ ਕੋਈ ਸਕਿਲ ਜ਼ਰੂਰ ਹੁੰਦੀ ਹੈ ਜਿਸ ਦੀ ਮਦਦ ਨਾਲ ਅਸੀਂ ਆਤਮ ਨਿਰਭਰ ਹੋ ਕੇ ਕਮਾ ਕੇ ਰੋਟੀ ਖਾ ਸਕਦੇ ਹਾਂ ਜਿਸ ਨੂੰ ਡਿਵਲਪ ਕਰਨ ਲਈ ਅਸੀਂ ਆਪਣੇ ਨਿੱਜੀ ਖਰਚੇ ਕੱਢ ਸਕਦੇ ਹਾਂ ਆਪਣਾ ਕੰਪਿਊਟਰ ਜਾਂ ਕੋਈ ਹੋਰ ਸੋਫਟ ਟ੍ਰੇਨਿੰਗ ਸਕਿਲ ਵਰਗੀਆਂ ਟਰੇਨਿੰਗਾਂ ਇਸ ਵਿੱਚ ਲਗਾਈਆਂ ਜਾਂਦੀਆਂ ਹਨ ਕਿ ਅਸੀਂ ਕਿਸ ਕਿਸੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਨੀ ਹੈ ਆਦਿ ਸਾਨੂੰ ਇਸ ਟ੍ਰੇਨਿੰਗ ਵਿੱਚ ਸਿਖਾਇਆ ਜਾਂਦਾ ਹੈ ਇਹ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਅਸੀਂ ਕੰਮ ਕਿੱਦਾਂ ਅਤੇ ਕਿਸ ਤਰੀਕੇ ਨਾਲ ਕਰਨਾ ਹੈ ਅ ਜਾਂ ਅਸੀਂ ਕੰਪਿਊਟਰ ਸਿੱਖ ਕੇ ਹੋਰ ਅੱਗੇ ਕੀ ਕੀ ਕਰ ਸਕਦੇ ਹਾਂ ਜਿਹੜੇ ਲੋਕ ਅਨਪੜ੍ਹ ਹੁੰਦੇ ਹਨ ਉਹਨਾਂ ਨੂੰ ਇਹ ਘਰ ਬੈਠੇ ਹੀ ਬਿਨਾਂ ਕਿਸੇ ਖਰਚੇ ਤੋਂ ਕੰਪਿਊਟਰ ਜਾਂ ਕੁਝ ਹੋਰ ਸਕਿਲਜ ਅ ਸਿਖਾਉਂਦੇ ਹਨ ਜਾਂ ਅਨਪੜ੍ਹ ਲੋਕਾਂ ਨੂੰ ਪੜ੍ਹਨਾ ਕਿੱਦਾਂ ਚਾਹੀਦਾ ਹੈ ਇਹ ਸਿਖਾਂਉਦੇ ਹਨ ਜਿਸ ਉੱਤੇ ਨਾ ਕੋਈ ਪੈਸਾ ਲੱਗਦਾ ਹੈ ਅਨਇਮਪਲੋਏਬਲ ਦੀ ਵੀ ਹੋ ਜਾਂਦੇ ਹਨ ਜਿਹੜੇ ਘਰ ਬੈਠ ਕੇ ਫਰੀ ਆਫ ਕੋਸਟ ਇਸਨੂੰ ਸਿੱਖ ਸਕਦੇ ਹਨ